ਜ਼ਿੰਦਗੀ ਵਿੱਚ ਕਲਾ ਦੀ ਬਹੁਤ ਸਾਰੀ ਅਹਿਮੀਅਤ ਹੁੰਦੀ ਹੈ ਕਲਾ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਕਿਸੇ ਵਿੱਚ ਡਾਂਸ ਦੀ ਕਲਾ ਹੁੰਦੀ ਹੈ ਕਿਸੇ ਵਿੱਚ ਕੂਕਿੰਗ ਦੀ ਕਲਾ ਹੁੰਦੀ ਹੈ ਕਿਸੇ ਵਿੱਚ ਸਿਗਿੰਗ ਦੀ ਕਲਾ ਹੁੰਦੀ ਹੈ ਅਤੇ ਕਿਸੇ ਵਿੱਚ ਪੇਂਟਿੰਗ ਦੀ ਜਾਂ ਡਰਾਇੰਗ ਦੀ ਕਲਾ ਹੁੰਦੀ ਹੈ ਕਲਾ ਬਹੁਤ ਹੀ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਸੇ ਵਿੱਚ ਭੰਗੜੇ ਦੀ ਵੀ ਕਲਾ ਹੁੰਦੀ ਹੈ ਅਤੇ ਹਰ ਕੋਈ ਆਪਣੀ ਆਪਣੀ ਕਲਾ ਦੇ ਨਾਲ ਹੀ ਜਾਣਿਆ ਜਾਂਦਾ ਹੈ ਹਰ ਕਿਸੇ ਦੀ ਪਹਿਚਾਣ ਆਪਣੀ ਕਲਾ ਨਾਲ ਹੀ ਹੁੰਦੀ ਹੈ ਕਲਾ ਜ਼ਿੰਦਗੀ ਵਿੱਚ ਸਭ ਦਾ ਅਹਿਮ ਹਿੱਸਾ ਹੈ ਸਾਨੂੰ ਇਸ ਨੂੰ ਸਿੱਖਣਾ ਚਾਹੀਦਾ ਹੈ ਹਰ ਇੱਕ ਚੀਜ਼ ਨੂੰ ਸਿੱਖਣਾ ਚਾਹੀਦਾ ਹੈ ਤਾਂ ਜੋ ਸਾਨੂੰ ਅੱਗੇ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਨਾ ਹੋਵੇ ਕਲਾ ਨਾਲ ਬੰਦਾ ਆਪਣੇ ਆਪ ਦੀ ਪਹਿਚਾਣ ਬਣਾਉਂਦਾ ਹੈ ਇੱਕ ਅਲੱਗ ਹੀ ਪਹਿਚਾਣ ਹੁੰਦੀ ਹੈ ਹਰ ਕੋਈ ਉਸਨੂੰ ਦੂਰੋਂ ਹੀ ਪਹਿਚਾਣਦਾ ਹੈ ਕਿ ਇਸ ਵਿੱਚ ਬਹੁਤ ਚੰਗੀ ਕਲਾ ਅਤੇ ਚੰਗੇ ਗੁਣ ਹਨ ਇਸ ਤਰ੍ਹਾਂ ਕਲਾ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਅਹਿਮ ਮਹੱਤਵ ਹੈ ਇਸ ਨੂੰ ਹਰ ਇੱਕ ਦੇ ਵਿੱਚ ਹੋਣਾ ਚਾਹੀਦਾ ਹੈ ਸਕੂਲ ਵਿੱਚ ਵੀ ਮੈਡਮਾਂ ਬੱਚਿਆਂ ਨੂੰ ਐਕਟੀਵਿਟੀਸ ਕਰਵਾਉਂਦੀਆਂ ਹਨ ਅਤੇ ਇਸ ਤਰ੍ਹਾ ਹੀ ਉਹ ਕਲਾ ਸਿੱਖਦੇ ਹਨ ਉਹਨਾਂ ਵਿੱਚ ਐਕਟਿਵ ਹੋਣ ਦੀ ਇੱਕ ਕਲਾ ਆਉਂਦੀ ਹੈ ਧੰਨਵਾਦ